ਵੈਸੇ ਤਾਂ ਗੱਲ ਕੀਤੀ ਜਾਵੇ ਮੈਂ ਕਾਫ਼ੀ ਸਾਰੀ ਚੀਜ਼ਾਂ ਇਹਦੇ ਵਿੱਚ ਵੀ ਰੁਚੀ ਰੱਖਦਾ ਹਾਂ ਪਰ ਇਹੋ ਜਿਹੀ ਇੱਕ ਅਜਿਹੀ ਚੀਜ਼ ਵੀ ਹੈ ਜਿਹਨੂੰ ਮੈਂ ਆਪਣੇ

ਅਤੇ ਇਸ ਤੋਂ ਬਾਅਦ ਮੈਂ ਗ੍ਰੈਜੂਏਸ਼ਨ ਵੀ ਕਰਨੀ ਹੈ ਇੰਜਨੀਅਰਿੰਗ ਦੇ ਵਿੱਚ ਮੈਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕਰ ਰਿਹਾ ਹਾਂ ਅਤੇ ਇਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਦਿਲ ਦਿਲਚਸਪੀ ਹੈ ਖ਼ਾਸ ਕਰ ਡਿਵਾਈਸਿਸ ਦੇ ਵਿੱਚ ਸੋਫਟਵੇਅਰਸ ਦੇ ਵਿੱਚ ਅਤੇ ਕੰਪਿਊਟਰਸ ਦੇ ਵਿੱਚ ਮੇਰਾ ਬਹੁਤ ਜ਼ਿਆਦਾ ਹੱਥ ਤੇਜ਼ ਵੀ ਹੈ ਅਤੇ ਮੈਂ ਇਹਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹਾਂ ਜੇ ਗੱਲ ਕੀਤੀ ਜਾਵੇ ਇੰਜੀਨੀਅਰਿੰਗ ਦੀ ਇੰਜੀਨੀਅਰਿੰਗ ਨੂੰ ਮੈਂ ਆਪਣੇ ਬਚਪਨ ਤੋਂ ਵੀ ਪਸੰਦ ਕਰਦਾ ਆਇਆ ਹਾਂ ਕਿਉਂਕਿ ਮੈਂ ਸ਼ੁਰੂ ਦੇ ਵਿੱਚ ਆਪਣੇ ਕੋਲੇਜ ਤੋਂ ਹੀ ਸਿੱਖੀ ਹੈ ਕੋਲੇਜ ਤੋਂ ਸਿੱਖਣ ਦਾ ਮਤਲਬ ਇਹ ਨਹੀਂ ਕਿ ਮੈਂ ਸ਼ੁਰੂ ਦੇ ਵਿੱਚ ਹੀ ਇੰਜੀਨੀਅਰਿੰਗ ਨੂੰ ਪਸੰਦ ਕਰਨ ਲੱਗ ਪਿਆ ਸੀ ਅਸਲ ਵਿੱਚ ਮੇਰੇ ਫਾਦਰ ਵੀ ਇੱਥੇ ਜੋਬ ਕਰਦੇ ਨੇ ਇੱਕ ਇੰਜੀਨੀਅਰਿੰਗ ਕੋਲੇਜ ਦੇ ਵਿੱਚ ਜੋਬ ਕਰਦੇ ਨੇ ਜਿਹਦੇ ਕਰਕੇ ਮੇਰੇ ਸ਼ੁਰੂ ਤੋਂ ਇਹ ਇੰਜੀਨੀਅਰਿੰਗ ਦੇ ਵਿੱਚ ਰੁਚੀ ਰਹੀ ਹੈ ਇਸ ਲਈ ਮੈਂ ਚਾਹੁੰਦਾ ਹਾਂ ਕਿ ਮੈਂ ਇੱਕ ਚੰਗਾ ਇੰਜੀਨੀਅਰ ਬਣਾ ਤਾਂ ਕਿ ਮੈਂ ਆਪਣੇ ਮਾਂ ਪਿਓ ਦਾ ਨਾਂ ਵੀ ਰੋਸ਼ਨ ਕਰ ਸਕਾਂ ਥੈਂਕ ਯੂ